ਹਾਂਜੀ ਬੋਲੀਵੁੱਡ ਦੀਆਂ ਫਿਲਮਾਂ ਕਾਫ਼ੀ ਹੱਦ ਤੱਕ ਜਿਹੜੀਆਂ ਕਿ ਸੱਭਿਆਚਾਰਕ ਬਣੀਆਂ ਹੁੰਦੀਆਂ ਨੇ ਉਹ ਬਹੁਤ ਹੀ ਵਧੀਆ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਪਹਿਰਾਵਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੁੰਦਾ ਸੀ ਕਿਉਂਕਿ ਜਿਹੜੀਆਂ ਅੱਜ ਕੱਲ੍ਹ ਦੀ ਫਿਲਮਾਂ ਨੇ ਉਹਨਾਂ ਦੇ ਵਿੱਚ ਕੱਪੜੇ ਬਹੁਤ ਹੀ ਕੁੜੀਆਂ ਘੱਟ ਪਾਉਂਦੀਆਂ ਨੇ ਜਿਹਨਾਂ ਕਰਕੇ ਕਿ ਸਾਨੂੰ ਉਹਨਾਂ ਫਿਲਮਾਂ ਨੂੰ ਦੇਖਣ ਲੱਗੇ ਵੀ ਕਾਫ਼ੀ ਸ਼ਰਮ ਮਹਿਸੂਸ ਹੁੰਦੀ ਹੈ ਪਹਿਲੇ ਫਿਲਮਾਂ ਹੁੰਦੀਆਂ ਸੀ ਜਿਹੜੇ ਕਿ ਅਸੀਂ ਆਪਣੀ ਪੂਰੇ ਪਰਿਵਾਰ ਵਿੱਚ ਬਹਿ ਕੇ ਦੇਖਦੇ ਸੀ ਕਿਉਂਕਿ ਉਹ ਕਲਾਕਾਰਾਂ ਨੇ ਕੱਪੜੇ ਵੀ ਪੂਰੇ ਪਾਏ ਹੁੰਦੇ ਸੀ ਅਤੇ ਅੱਜ ਕੱਲ੍ਹ ਦੀਆਂ ਫ਼ਿਲਮਾਂ ਜਿਹੜੀਆਂ ਕਿ ਛੋਟੇ ਕੱਪੜੇ ਪਾ ਕੇ ਕੁੜੀ ਬਣਾਉਂਦੀਆਂ ਨੇ ਜਿਹੜੇ ਕਲਾਕਾਰ ਬਣਾਉਂਦੇ ਨੇ ਉਹ ਕੱਪੜੇ ਉਹ ਫਿਲਮਾਂ ਤਾਂ ਅਸੀਂ ਇਕੱਲੇ ਦੇਖਣ ਲੱਗੇ ਵੀ ਸ਼ਰਮ ਮਹਿਸੂਸ ਕਰਦੀਆਂ ਹਾਂ ਕਾਫ਼ੀ ਹੱਦ ਤੱਕ ਫਿਲਮਾਂ ਐਸੀਆਂ ਨੇ ਜਿਹੜੇ ਕਿ ਪੰਜਾਬੀ ਸੂਟ ਪਟਿਆਲਾ ਸੂਟ ਸਲਵਾਰ ਸੂਟ ਵਿੱਚ ਪਾ ਕੇ ਕਾਫ਼ੀ ਹੱਦ ਤੱਕ ਸਫ਼ਲ ਵੀ ਰਹੀਆਂ ਹਨ ਅਤੇ ਮੇਂ ਉਹਨਾਂ ਪਹਿਰਾਵਿਆਂ ਨੂੰ ਘਰ ਬਣਾ ਕੇ ਸਿਲਾਈ ਦੇ ਵਿੱਚੋਂ ਸਲਵਾਰਾਂ ਸੂਟ ਬਣਵਾ ਕੇ ਪੰਜਾਬੀ ਸੂਟ ਪਰੋ ਕੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਨੂੰ ਉਹ ਸੂਟ ਸੱਜਦੇ ਵੀ ਹੈ ਉਹ ਸੂਟ ਮੈਨੂੰ ਪਸੰਦ ਵੀ ਨੇ ਅਤੇ ਮੈਂ ਤਾਂ ਇਹ ਕਹਿੰਦੀ ਅੱਜ ਕੱਲ੍ਹ ਦੀ ਕੁੜੀਆਂ ਨੂੰ ਪੰਜਾਬੀ ਸੱਭਿਆਚਾਰਕ ਕੁੜੀਆਂ ਵਿੱਚ ਜਿਹੜੇ ਪਹਰਾਵੇ ਹੁੰਦੇ ਨੇ ਪੰਜਾਬੀ ਸੂਟ ਸਲਵਾਰ ਸੂਟ ਪਟਿਆਲਾ ਸੂਟ ਪਜਾਮੀ ਸੂਟ ਇਹੋ ਜਿਹੇ ਸੂਟਾਂ ਦਾ ਹੀ ਚੁਣਾਵ ਕਰਨਾ ਚਾਹੀਦਾ ਹੈ ਸਾਨੂੰ ਅੱਜ ਕੱਲ੍ਹ ਦੇ ਰਿਵਾਜ਼ ਜਿਹੜੇ ਚੱਲਦੇ ਨੇ ਛੋਟੇ ਛੋਟੇ ਕੱਪੜਿਆਂ ਵਾਲੇ ਉਹਨਾਂ ਵੱਲ ਨਹੀਂ ਧਿਆਨ ਦੇਣਾ ਚਾਹੀਦਾ ਇਸ ਦੇ ਨਾਲ ਸਾਡਾ ਸਭਿਆਚਾਰਕ ਵੀ ਚੱਲਦਾ ਰਹੇਗਾ ਅਤੇ ਸਾਡੇ ਸ਼ੋਂਕ ਵੀ